ਪੰਜਾਬੀ ਭਾਸ਼ਾ ਦੇਖਿਆ ਜਾਵੇ ਤਾਂ ਇਹਦੇ 'ਚ ਬਹੁਤ ਗੂੜੇ ਇੱਦਾਂ ਦੇ ਵਰਡਸ ਹੁੰਦੇ ਆ ਜਿਹੜੇ ਲੋਕਾਂ ਨੂੰ ਨਹੀਂ ਸਮਝ ਆਉਂਦੇ ਜੇ ਆਪਾਂ ਦੂਜੀ ਲੈਂਗੁਏਜਜ ਦੂਜੀਆਂ ਭਾਸ਼ਾਵਾਂ ਦੀ ਗੱਲ ਕਰੀਏ ਜਿਵੇਂ ਹਿੰਦੀ ਜਾਂ ਕੁਝ ਇੰਗਲਿਸ਼ ਹਿੰਦੀ ਦੇਖਿਆ ਜਾਵੇ ਤਾਂ ਨੈਸ਼ਨਲ ਲੈਂਗੁਏਜ ਹੈ ਬਹੁਤ ਸਾਰੇ ਸਟੇਟਸ ਦੇ ਬਹੁਤ ਸਾਰੇ ਡਿਫਰੈਂਟ ਜਗ੍ਹਾ ਦੇ ਲੋਕਾਂ ਨੂੰ ਸਭ ਸਮਝ ਆਉਂਦਾ ਪਰ ਜੇ ਪੰਜਾਬੀ ਅਸੀਂ ਪੂਰੀ ਗੂੜ੍ਹ ਪੰਜਾਬੀ ਬੋਲੀਏ ਤਾਂ ਕੁਛ ਵਰਡਸ ਇੱਦਾਂ ਦੇ ਹੋ ਜਾਂਦੇ ਆ ਜਿਹੜੇ ਉਹਨਾਂ ਨੂੰ ਨਹੀਂ ਸਮਝ ਆਉਂਦੇ ਅਤੇ ਜੇ ਉੱਦਾਂ ਦਾ ਬੰਦਾ ਜਿਹਨੂੰ ਸਿਰਫ ਆਉਂਦੀ ਪੰਜਾਬੀ ਹੈ ਹੋਰ ਵਰਡ ਆਉਂਦੇ ਹੀ ਨਹੀਂ ਤਾਂ ਉਹ ਬੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਜੇ ਆਪਾਂ ਦੂਜੀ ਸਟੇਟਸ ਵੀ ਜਾਈਏ ਤਾਂ ਉੱਥੇ ਨਹੀਂ ਸਮਝ ਆਉਂਦੀ ਅਤੇ ਜੇ ਬਾਹਰਲੇ ਮੁਲਕ 'ਚ ਜਾਈਏ ਜਿਵੇਂ ਕਨੇਡਾ ਵਗੈਰਾ ਤਾਂ ਉੱਥੇ ਹੋਰ ਵੀ ਮੁਸ਼ਕਲ ਆਉਂਦੀ ਹੈ ਬਜ਼ੁਰਗਾਂ ਨੂੰ ਤਾਂ ਹੋਰ ਵੀ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਅੱਜ ਦਾ ਸਮਾਂ ਥੋੜ੍ਹਾ ਚੇਂਜ ਹੋ ਗਿਆ ਤਾਂ ਅੱਜ ਆਪਾਂ ਪੰਜਾਬੀ ਹਿੰਦੀ ਸਭ ਮਿਕਸ ਕਰ ਦਿੰਦੇ ਹਾਂ ਤਾਂ ਥੋੜ੍ਹਾ ਸਮਝਾ ਵੀ ਦਿੰਦੇ ਹਾਂ ਦੂਜੇ ਬੰਦੇ ਨੂੰ ਪਰ ਉਹਨਾਂ ਨੂੰ ਨਹੀਂ ਸਮਝ ਆਉਂਦਾ ਤਾਂ ਇਸ ਕਰਕੇ ਪੰਜਾਬੀ ਦੀ ਭਾਸ਼ਾ ਬੋਲਣ ਦੀਆਂ ਚੁਣੌਤੀਆਂ ਤਾਂ ਹੈ ਹੀ ਪਰ ਇਹ ਬੜੀ ਹੀ ਪਿਆਰੀ ਲੈਂਗੁਏਜ ਹੈ ਬੜਾ ਹੀ ਵਧੀਆ ਜੋ ਪੰਜਾਬ 'ਚ ਰਹਿੰਦੇ ਹੈ ਉਹ ਪੰਜਾਬੀ ਭਾਸ਼ਾ ਬੋਲ ਕੇ ਬੜੇ ਖੁਸ਼ ਹੁੰਦੇ ਆ ਅਤੇ ਜੇ ਆਪਾਂ ਦੂਜੀ ਰਾਜਾਂ ਦੀ ਗੱਲ ਕਰੀਏ ਤਾਂ ਉਹ ਸਾਰੇ ਹਿੰਦੀ ਨੂੰ ਹੀ ਜ਼ਿਆਦਾ ਤਵੱਜੋ ਦਿੰਦੇ ਹਨ